ਬਦਲਦੇ ਮੌਸਮ ਦਾ ਕਿਸਾਨਾਂ ਦੀ ਖੇਤੀ 'ਤੇ ਬਹੁਤ ਹੀ ਜ਼ਿਆਦਾ ਅਸਰ ਪੈਂਦਾ ਹੈ ਜਦੋਂ ਕੋ ਜਦੋਂ ਕਈ ਵਾਰ ਛੇ ਮਹੀਨਿਆਂ ਦੀ ਮਿਹਨਤ ਕੀਤੀ ਹੋਈ ਫਸਲ ਦੇ ਵੱਢਣ 'ਤੇ ਹੜ੍ਹ ਮੀਂਹ ਤੂਫਾਨ ਗੜੇ ਦੀ ਮਾਰ ਹੋ ਜਾਂਦੀ ਹੈ ਤਾਂ ਕਿਸਾਨ ਦਾ ਕਿਸਾਨਾਂ ਦਾ ਦਿਲ ਟੁੱਟ ਜਾਂਦਾ ਹੈ ਜਿਵੇਂ ਕਿ ਹੁਣ ਥੋੜ੍ਹੇ ਮਹੀਨੇ ਪਹਿਲਾਂ ਹੀ ਹੜ੍ਹ ਆਇਆ ਸੀ ਉਦੋਂ ਜੀਰੀਆਂ ਲੱਗੀਆਂ ਹੋਈਆਂ ਸਨ ਤਾਂ ਹੜ੍ਹ ਕਾਰਨ ਸਾਰੀ ਫਸਲ ਖਰਾਬ ਹੋ ਗਈ ਸੀ ਪਾਣੀ ਵਿੱਚ ਡੁੱਬ ਗਈ ਸੀ ਫਿਰ ਕਿਸਾਨ ਦੁਬਾਰਾ ਤੋਂ ਪਨੀਰੀ ਬੀਜਦਾ ਹੈ ਅਤੇ ਉਸ ਉੱਪਰ ਦੁਬਾਰਾ ਤੋਂ ਖਰਚਾ ਕਰਦਾ ਹੈ ਸਰਕਾਰ ਨੇ ਕੁਝ ਕਿਸਾਨਾਂ ਨੂੰ ਤਾਂ ਮੁਆਵਜ਼ਾ ਦਿੱਤਾ ਸੀ ਕੁਝ ਕੁ ਰਹੇ ਇਨਸ ਇਨਸਾਨ ਜਿਨ੍ਹਾਂ ਨੂੰ ਇਹ ਮਾਰ ਝੱਲਣੀ ਪਈ ਇਸ ਤਰ੍ਹਾਂ ਜਦੋਂ ਗੜੇ ਪੈ ਜਾਂਦੇ ਹਨ ਤਾਂ ਨਰਮੇ ਦੀ ਖੜੀ ਫਸਲ ਤਬਾਹ ਕਰ ਦਿੰਦਾ ਹੈ ਇਹੋ ਜਿਹੀਆਂ ਸਮੱਸਿਆਵਾਂ ਕਾਰਨ ਕਿਸਾਨ ਕਰਜ਼ਈ ਹੋ ਜਾਂਦਾ ਹੈ ਜੋ ਕਿਸਾਨ ਏਂਵ ਇਸ ਤਰ੍ਹਾਂ ਕਰਜ਼ਈ ਹੋ ਜਾਂਦੇ ਹਨ ਤਾਂ ਉਹ ਆਤਮ ਹੱਤਿਆ ਕਰ ਲੈਂਦੇ ਹਨ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ ਸਰਕਾਰ ਨੂੰ ਕਿਸਾਨਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਦਾ ਅੰਨਦਾਤਾ ਹੈ